ਮੇਰੇ ਸਥਾਨ ਤੋਂ ਪਰਨੀਤ ਕੌਰ ਮਢਾਲੀ ਜੋ ਕਿ ਦੌੜ ਚ ਆਪਣਾ ਮੈਡਲ ਪੱਕਾ ਕਰਕੇ ਆਈ ਸੀ ਏਸੀਅਨ ਗੇਮਾਂ ਚ ਅਤੇ ਇਸ ਤੋਂ ਇਲਾਵਾ ਰੋਇੰਗ ਚ ਸੁਖਮੀਤ ਸਿੰਘ ਅਤੇ ਸਤਨਾਮ ਸਿੰਘ ਇਹ ਵੀ ਮੇਰੇ ਇਲਾਕੇ ਦੇ ਸਿਰ ਕੱਢ ਖਿਡਾਰੀ ਨੇ ਜੋ ਵੀ ਇਕ ਇਹ ਵੀ ਏਸੀਅਨ ਗੇਮਾਂ ਚੋਂ ਆਪੋਂ ਆਪਣੇ ਮੈਡਲ ਲਿਆ ਕੇ ਆਪਣੇ ਜ ਆਪਣੇ ਜਿਲ੍ਹੇ ਦਾ ਆਪਣੇ ਪਿੰਡ ਦਾ ਆਪਣੇ ਆਪਣੇ ਸੂਬੇਦਾਰ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਕੇ ਆਏ ਨੇ ਇਸ ਤੋਂ ਇਲਾਵਾ ਐਥਲੀਟ ਕੋਚ ਨਰੇਸ਼ ਕੁਮਾਰ ਜੀ ਅਤੇ ਮੈਡਮ ਸਾਲੂ ਜੀ ਅਤੇ ਇਸ ਤੋਂ ਇਲਾਵਾ ਬਲਵੰਤ ਸਿੰਘ ਜੀ ਬਹੁਤ ਸਾਡੇ ਸਾਡੇ ਕੋਚ ਅਤ ਕੋਚ ਅਤੇ ਪ੍ਰਸ਼ਾਸਕ ਨੇ ਨੇ ਤੇ ਇਸ ਹੋਰ ਵੀ ਸਾਡੇ ਇਲਾਕੇ ਦੇ ਬਹੁਤ ਖਿਡਾਰ ਖਿਡਾਰੀ ਜੋ ਕਿ ਆਪੋ ਆਪਣੇ ਖੇਡਾਂ ਚ ਨਿਪੁੰਨ ਨੇ ਤੇ ਇਸ ਮੇਰੇ ਇਲਾਕੇ ਦੇ ਤੋਮਾਨ ਮਾਨ ਭਰੇ ਪਲ ਇਹਨਾਂ ਖਿਡਾਰੀਆਂ ਨੇ ਸਦਾ ਦੁਆਵਾਂ ਦਿੰਦੇ ਆਂ ਅਸੀਂ ਤੇ ਇਹੀ ਮੇਰੇ ਇਲਾਕੇ ਦਾ ਸਰਮੋਤਮ ਖਿਡਾਰੀ ਐ ਖਿਡਾਰੀ ਨੇ ਅਸੀਂ ਇਹਨਾਂ ਨੂੰ ਸਦ ਸਦਾ ਸਲਾਮ ਕਰਦੇ ਹਾਂ